ਵੈਸੇ ਤਾਂ ਮੇਰੇ ਕੋਲ ਕੋਈ ਕੁੱਕ ਬੁੱਕ ਨਹੀਂ ਹੈ ਪਰ ਮੈਂ ਯੂਟਿਊਬ ਤੋਂ ਫੂਡ ਬਲੋਗ ਜਾਂ ਰੈਸਪੀਜ਼ ਵੀਡੀਓਜ਼ ਦੇਖ ਕੇ ਖਾਣਾ ਬਣਾਉਂਦੀ ਹਾਂ ਡਿਸਿਜ਼ ਬਣਾਉਂਦੀ ਹਾਂ ਨਵੀਆਂ ਨਵੀਆਂ ਰੋਜ਼ ਅਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਮੈਨੂੰ ਸ਼ੌਕ ਵੀ ਹੈ ਕਿ ਮੈਂ ਰੋਜ਼ ਕੁਛ ਨਾ ਕੁਛ ਨਵਾਂ ਕਰਕੇ ਦੇਖਾਂ ਅਤੇ ਮੈਂ ਬਹੁਤ ਕੁਛ ਸਿੱਖਿਆ ਹੈ ਯੂਟਿਊਬ ਤੋਂ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰੇ ਵੇ ਹੋਏ ਹੈਗੇ ਆ ਅਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਮੈਂ ਆਪਣੀ ਫੈਮਿਲੀ ਨੂੰ ਰੋਜ਼ ਕੁਛ ਨਾ ਕੁਛ ਨਵਾਂ ਬਣਾ ਕੇ ਖਵਾਉਂਦੀ ਹਾਂ ਅਤੇ ਸਿੱਖਦੀ ਰਹਿੰਦੀ ਹਾਂ